ਕੀ ਤੁਸੀਂ ਇੱਕ ਮਨ ਪਸੰਦ ਭੰਗੜਾ ਐਰੋਬਿਕਸ ਟੀਮ ਦੀ ਵਰਤੋਂ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਭੰਗੜਾ ਲੈਣ ਲੈਂਦੇ ਹੋਣ ਜੀ ਬਿਲਕੁਲ ਮੈਂ ਕਰਦਾ ਹਾਂ ਮੈਂ ਐਰੋਬਿਕਸ ਕਰਦਾ ਹਾਂ ਅਤੇ ਮੇਰੇ ਉਹਦੇ ਥਰੂ ਮੇਰੀ ਜਦੋਂ ਸਰੀਰ ਦੀ ਕਸਰਤ ਹੁੰਦੀ ਹੈ ਉਹਦੇ ਵਿੱਚ ਜਿੱਦਾਂ ਕਿ ਮੈਂ ਦੱਸਿਆ ਮੈਂ ਭੰਗੜਾ ਵੀ ਸ਼ਾਮਿਲ ਕਰਦਾ ਹਾਂ ਭੰਗੜਾ ਸਾਡੇ ਸਰੀਰ ਦਾ ਇੱਕ ਇੰਪੋਰਟੈਂਟ ਪਾਰਟ ਹੈ ਸਾਡੇ ਨੱਚਣ ਦੇ ਤਰੀਕੇ ਨਾਲ ਸਾਡੀ ਬੋਡੀ ਸਾਡਾ ਜ਼ਿਆਦਾ ਸਰੀਰ ਲਚਕਦਾਰ ਬਣਦਾ ਹੈ ਸਾਡੇ ਪੰਜਾਬ ਵਿੱਚ ਭੰਗੜਾ ਇੱਕ ਬਹੁਤ ਹੀ ਵੱਡੀ ਵੱਡੀ ਡਾਂਸ ਦੀ ਕਲਾ ਹੈ ਅਸੀਂ ਕਿਸੇ ਵੀ ਪਾਰਟੀਆਂ ਅਤੇ ਵਿਆਹਾਂ ਸ਼ਾਦੀਆਂ ਵਿੱਚ ਜਾ ਕੇ ਅਸੀਂ ਨੱਚਦੇ ਹਾਂ ਮੋਸਟਲੀ ਅਸੀਂ ਭੰਗੜਾ ਕਰਦੇ ਹਾਂ ਅਤੇ ਭੰਗੜਾ ਸਾਡੇ ਸਰੀਰ ਦੀ ਕਸਰਤ ਕਰਨ 'ਚ ਵੀ ਕਾਫੀ ਮਦਦ ਕਰਦਾ ਹੈ ਐਰੋਬਿਕਸ ਵਿੱਚ ਮੈਂ ਭੰਗੜਾ ਬਿਲਕੁਲ ਕਰਦਾ ਹਾਂ ਮੈਂ ਦੋ ਤਰ੍ਹਾਂ ਦੀ ਅ ਐਰੋਬਿਕਸ ਰੁਟੀਨ ਫੋਲੋ ਕਰਦਾ ਹਾਂ ਇੱਕ ਲਾਈਟ ਐਰੋਬਿਕਸ ਅਤੇ ਦੂਜੀ ਹੈਵੀ ਐਰੋਬਿਕਸ ਲਾਈਟ ਰੋਬਿਕਸ ਵਿੱਚ ਮੈਂ ਮੂਵਮੈਂਟ ਕਰਦਾ ਹਾਂ ਆਪਣੀ ਬੋਡੀ ਦੀ ਜਿਹਦੇ ਵਿੱਚ ਮੇਰੀ ਜਿਹੜੀਆਂ ਹੱਡੀਆਂ ਅਤੇ ਮੇਰੇ ਮਾਸਪੇਸ਼ੀਆਂ ਹਨ ਇਹ ਲਚਕਦਾਰ ਬਣਦੀ ਹੈ ਅਤੇ ਹੈਵੀ ਅਰੋਬਿਕਸ ਵਿੱਚ ਮੈਂ ਪਸੀਨਾ ਕੱਢ ਕੇ ਜ਼ਿਆਦਾ ਮਿਹਨਤ ਕਰਦਾ ਹਾਂ ਜਿਹਦੇ ਨਾਲ ਮੈਨੂੰ ਭੁੱਖ ਲੱਗਦੀ ਹੈ ਮੈਨੂੰ ਜ਼ਿਆਦਾ ਖਾਣਾ ਪਵੇ ਖਾਣਾ ਖਾਣਾ ਮਿਲਦਾ ਹੈ ਅਤੇ ਮੇਰਾ ਸਰੀਰ ਤਾਕਤਵਰ ਬਣਦਾ ਹੈ ਇਹਦੇ ਇਹਦੇ ਨਾਲ ਦੀ ਨਾਲ ਮੈਨੂੰ ਵਧੀਆ ਜਿਹੜੀ ਚੀਜ਼ ਲੱਗਦੀ ਹੈ ਉਹ ਹੈਗੀ ਮੇਰੀ ਹੈਵੀ ਐਰੋਬਿਕਸ ਦੀ ਜਿੰਮ ਟਰੇਨਿੰਗ ਕਿ ਕਿਹੜੀ ਚੀਜ਼ ਤੁਹਾਨੂੰ ਤੁਹਾਡੇ ਲਈ ਖਾਸ ਬਣਾਉਂਦੀ ਹੈ ਜੀ ਇਹੀ ਜਿੰਮ ਟ੍ਰੇਨਿੰਗ ਮੈਨੂੰ ਮੇਰੇ ਐਰੋਬਿਕਸ ਰੂਟੀਨ ਵਿੱਚ ਮੇਰੇ ਕਸਰਤ ਵਿੱਚ ਖਾਸ ਬਣਾਉਂਦੀ ਹੈ ਭੰਗੜੇ ਦੇ ਨਾਲ ਨਾਲ ਜਿਹਦੇ ਨਾਲ ਮੇਰਾ ਸਰੀਰ ਲਚਕਦਾਰ ਬਣੇ ਅਤੇ ਨਾਲ ਦੀ ਨਾਲ ਮੈਂ ਜਿੰਮ ਵਾਲੀ ਹੈਵੀ ਟਰੈਨਿੰਗ ਕਰਦਾ ਹਾਂ ਜਿਹਦੇ ਨਾਲ ਮੇਰੇ ਸਰੀਰ ਵਿੱਚ ਜਾਨ ਆਵੇ ਤਾਕਤਵਰ ਬਣੇ ਅਤੇ ਮੇਰਾ ਸਰੀਰ ਜ਼ਿਆਦਾ ਉਮਰ ਤੱਕ ਵਧੀਆ ਟਿਕਾਓ ਬਣਿਆ ਰਹੇ